ਇੱਕ ਵਾਰ ਦੀ ਗੱਲ ਹੈ ਕਿ ਮੈਂ ਆਪਣੀ ਮਾਸੀ ਦੇ ਮੁੰਡੇ ਕੋਲ ਗਿਆ ਹੋਇਆ ਸੀ ਅਤੇ ਬੈਠੇ ਬਿਠਾਏ ਹੀ ਉਹ ਫਲਿੱਪਕਾਰਟ 'ਤੇ ਦੇਖ ਰਿਹਾ ਔਨਲਾਈਨ ਬੂਟ ਦੇਖ ਰਿਹਾ ਸੀ ਮੈਂ ਉਸਨੂੰ ਪੁੱਛਿਆ ਕਿ ਤੂੰ ਬੂਟ ਲੈਣੇ ਹਨ ਤਾਂ ਉਸਨੇ ਮੈਨੂੰ ਕਿਹਾ ਕਿ ਸੇਲ ਚੱਲ ਰਹੀ ਹੈ ਜਿੱਥੇ ਕਿ ਕੰਪਨੀ ਦੇ ਬੂਟ ਬਹੁਤ ਹੀ ਸਸਤੇ ਅਤੇ ਕੌਂਬੋ ਮਿਲ ਰਹੇ ਹਨ ਅਤੇ ਉਹ ਮਨ ਹੀ ਮਨ ਵੀ ਮੇਰੇ ਮਨ ਵਿੱਚ ਖਿਆਲ ਆਇਆ ਕਿ ਬੂਟ ਰਨਿੰਗ ਸ਼ੂਜ ਤਾਂ ਮੇਰੇ ਵੀ ਖਰਾਬ ਹੋ ਗਏ ਹਨ ਜਿਸ ਕਰਕੇ ਮੈਂ ਵੀ ਉਸ ਨਾਲ ਸਲਾਹ ਕਰਕੇ ਰਨਿੰਗ ਸ਼ੂਜ ਮੰਗਵਾ ਲਏ ਜੋ ਕਿ ਸਾਲ ਦੀ ਗਰੰਟੀ ਵਿੱਚ ਸਨ ਅਤੇ ਜਦੋਂ ਵੀ ਉਹ ਸਾਡੇ ਕੋਲ ਡਿਲੀਵਰ ਹੋਏ ਤਾਂ ਉਹ ਐਨੇ ਆਕਰਸ਼ਿਤ ਸੀ ਕਿ ਬਹੁਤ ਹੀ ਹਲਕੇ ਫੁਲਕੇ ਸੀ ਅਤੇ ਭੱਜਣ ਲਈ ਵੀ ਬਹੁਤ ਠੀਕ ਸਨ ਅਤੇ ਮੇਰੇ ਤੋਂ ਕਈ ਮੇਰੇ ਦੋਸਤਾਂ ਨੇ ਪੁੱਛਿਆ ਕਿ ਤੂੰ ਇਹ ਕਿੱਥੋਂ ਮੰਗਵਾਏ ਹਨ ਅਤੇ ਉਹਨਾਂ ਦਾ ਰੰਗ ਵੀ ਕੁਛ ਅਲੱਗ ਹੀ ਸੀ ਜੋ ਕਿ ਪੁੰਮਾ ਕੰਪਨੀ ਦੇ ਸਨ ਅਤੇ ਉਹਨਾਂ ਦੀ ਸਾਲ ਦੀ ਗਰੰਟੀ ਵੀ ਸੀ